ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੈਨੂੰ ਬਹੁਤ ਜ਼ਿਆਦਾ ਰਾਤ ਦੇ ਬਾ ਮੇਰੀ ਰਾਤ ਦੇ ਇੱਕ ਵਜੇ ਫਲਾਈਟ ਹੈ ਅਤੇ ਮੈਂ ਕੋਈ ਕੈਬ ਜਾਂ ਆਟੋ ਬੁੱਕ ਕਰਨਾ ਚਾਹੁੰਦੀ ਹਾਂ ਮੈਨੂੰ ਬਾਰ੍ਹਾਂ ਵਜੇ ਰਾਤ ਦੇ ਬਾਰ੍ਹਾਂ ਵਜੇ ਇੱਕ ਕੈਬ ਚਾਹੀਦੀ ਆ ਜਿਸਦਾ ਸਮਾਂ ਜਿਸਦਾ ਸਮਾਂ ਬਾਰ੍ਹਾਂ ਵਜੇ ਹੈ ਅਤੇ ਮੈਨੂੰ ਪਿਕਅਪ ਕਰਨ ਦਾ ਸਥਾਨ ਚੰਡੀਗੜ੍ਹ ਹੈ ਅਤੇ ਮੈਨੂੰ ਇਸ ਜਗ੍ਹਾ ਤੋਂ ਪਿਕ ਕੀਤਾ ਜਾਵੇ ਅਤੇ ਮੈਨੂੰ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਆ ਰਾਤ ਦੇ ਬਾਰ੍ਹਾਂ ਵਜੇ ਅਤੇ ਇੱਕ ਵਜੇ ਮੇਰੀ ਫਲਾਈਟ ਹੈ ਜਿਸ ਨੂੰ ਫੜਨ ਲਈ ਮੈਨੂੰ ਇੱਕ ਕੈਬ ਚਾਹੀਦੀ ਹੈ